ਹਾਂਜੀ ਵੀਰ ਜੀ ਮੈਂ ਨਾ ਰਾਜਵੀਰ ਸਿੰਘ ਬੋਲਦਾ ਵਾ ਫੇਸ ਵੰਨ ਦੋ ਸੌ ਤਰਵੰਜਾ ਨੰਬਰ ਹਾਊਸ ਚੋਂ ਤੁਸੀਂ ਅਨੇਜਾ ਸਵੀਟ ਤੋਂ ਬੋਲਦੇ ਹੋ ਨਾ ਹਾਂਜੀ ਅਤੇ ਸਾਡੇ ਨਾ ਪਾਰਟੀ ਆ ਇੱਕ ਸੌ ਕੁ ਬੰਦੇ ਦੀ ਹਾਂਜੀ ਮੇਰੇ ਬੇਟੇ ਜਨਮ ਦਿਨ ਹੈ ਹਾਂਜੀ ਅਤੇ ਸਾਨੂੰ ਖਾਣਾ ਚਾਹੀਦਾ ਸੀਗਾ ਥੋੜ੍ਹਾ ਜਿਹਾ ਵਧੀਆ ਹਾਂਜੀ ਅਤੇ ਤੁਸੀਂ ਅਰੇਂਜਮੈਂਟ ਕਰਵਾ ਦੋਂਗੇ ਅੱਛਾ ਕਰਵਾ ਦੋਂਗੇ ਅਤੇ ਸਾਨੂੰ ਟਾਈਮ ਟੇਬਲ ਨਾਲ ਚਾਹੀਦਾ ਇਹ ਚਾਹੀਦਾ ਆਪਾਂ ਨੂੰ ਇੱਕੀ ਫਰਵਰੀ ਨੂੰ ਹਾਂਜੀ ਸ਼ਾਮ ਨੂੰ ਬਸ ਅੱਠ ਕੁ ਵਜੇ ਦੇ ਕਰੀਬ ਹਾਂਜੀ ਹਾਂਜੀ ਅਤੇ ਖਾਣਾ ਵਧੀਆ ਹੋਵੇ ਦੋ ਸਬਜ਼ੀਆਂ ਹੋਣ ਅਤੇ ਨਾਲ ਸਲਾਦ ਅਤੇ ਹਲਵਾ ਤਾਂ ਨਹੀਂ ਹੋਏਗਾ ਹਲਵਾ ਨਹੀਂ ਗਜਰੇਲਾ ਹਾਂਜੀ ਗਜਰੇਲਾ ਦੇ ਦੇਣਾ ਫਿਰ ਹਾਂਜੀ ਸੌ ਕੁ ਪਲੇਟ ਅਤੇ ਮਟਰ ਪਨੀਰ ਦੀ ਸਬਜ਼ੀ ਹੋਵੇ ਵਧੀਆ ਹਾਂਜੀ ਹਾਂਜੀ ਇੱਕ ਸੁੱਕੀ ਚਲ ਜਾਵੇਗੀ ਅਤੇ ਵਧੀਆ ਖਾਣਾ ਹੋਵੇ ਬਸ ਹਾਂਜੀ ਅਤੇ ਨਾਲ ਟਾਈਮ ਤੁਹਾਨੂੰ ਦੱਸ ਦਾਂਗੇ ਵੀ ਅੱਠ ਕੁ ਵਜੇ ਦੇ ਕਰੀਬ ਦਾ ਦਸ ਮਿੰਟ ਉੱਪਰ ਥੱਲੇ ਹੋ ਜਾਣ ਵੱਧ ਟਾਈਮ ਨਾ ਹੋਵੇ ਹਾਂਜੀ ਹਾਂ ਅਤੇ ਤੁਸੀਂ ਐ ਕਰਨਾ ਪੈਕਿੰਗ ਇਸ ਹਿਸਾਬ ਨਾਲ ਕਰ ਦੇਣਾ ਕਿ ਅਸੀਂ ਆ ਜਾਈਏ ਅਤੇ ਨਾਲ ਦੀ ਨਾਲ ਤੁਸੀਂ ਔਡਰ ਉਹ ਭਿਜਵਾ ਦੇਣਾ ਹਾਂਜੀ ਉਹ ਤਾਂ ਚਲੋ ਮੋਕੇ 'ਤੇ ਫੋਨ ਕਰ ਲਾਂਗੇ ਤੁਹਾਨੂੰ ਬਸ ਖਾਣੇ ਦੀ ਕਿਸੀ ਕਿਸਮ ਦੀ ਸ਼ਿਕਾਇਤ ਨਾ ਆਵੇ ਠੀਕ ਹੈ ਜੀ ਹਾਂਜੀ ਅਤੇ ਪੇ ਮੈਂ ਇੱਕ ਦਿਨ ਪਹਿਲਾਂ ਆ ਕੇ ਕਰ ਜੂੰਗਾ ਹਾਂਜੀ ਹਾਂਜੀ ਠੀਕ ਹੈ ਜੀ ਬਸ ਖਾਣਾ ਐਨ ਵਧੀਆ ਹੋਵੇ ਫਸਟ ਕਲਾਸ ਜਿਹਾ ਠੀਕ ਹੈ ਜੀ

ਹਾਂਜੀ ਨੋਟ ਕਰ ਲਿਓ ਬਸ ਠੀਕ ਹੈ ਸਰ ਥੈਂਕ ਯੂ ਜੀ ਓਕੇ